ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਫਤਿਹਗੜ੍ਹ ਸਾਹਿਬ ਆ ਕੇ ਇੱਧਰ ਬਹੁਤ ਹੀ ਵਧੀਆ ਖਾਣੇ ਮਿਲਦੇ ਹਨ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਤੰਦੂਰੀ ਚਿਕਨ ਛੋਲੇ ਭਟੂਰੇ ਲੱਸੀ ਅਤੇ ਨਾਲ ਆਹ ਅੰਮ੍ਰਿਤਸਰੀ ਕੁਲਚੇ ਸਾਊਥ ਇੰਡੀਅਨ ਫਤਿਹਗੜ੍ਹ ਸਾਹਿਬ 'ਚ ਮੇਨ ਨੇ ਨੇੜੇ ਨੇੜੇ ਹੀ ਹਨ ਸਾਊਥ ਇੰਡੀਅਨ ਵੀ ਮਿਲਦਾ ਉਰੇ ਡੋਸੇ ਵਗੈਰਾ ਜੇ ਤੁਸੀਂ ਖਾਣਾ ਚਾਹੁੰਦੇ ਆ ਉਹਦੀ ਵੀ ਮਸ਼ਹੂਰ ਦੁਕਾਨ ਆ ਉਰੇ ਤੁਸੀਂ ਤੁਸੀਂ ਜਦ ਵੀ ਉਰੇ ਆਉ ਤਾਂ ਤਾਂ ਮੈਨੂੰ ਦੱਸ ਦਿਉ ਵੀ ਤੁਹਾਡੇ ਅਸੀਂ ਉਰੇ ਹੋਟਲ 'ਚ ਬੈਠਣ ਦਾ ਬੈਠ ਕੇ ਕਿਸੇ ਵੀ ਜਿਹੜੇ ਜਿਹੜੇ 'ਚ ਖਾਣਾ ਉੱਥੇ ਅਸੀ ਆਪਾਂ ਟਾਈਮ ਬੁੱਕ ਕਰ ਦਾਂਗੇ ਅੰਮ੍ਰਿਤਸਰ ਇੱਧਰ ਰਸਤੇ 'ਚ ਵੀ ਕੋਟਕਪੂਰੇ ਬਹੁਤ ਵਧੀਆ ਉੱਥੇ ਆਟੇ ਵਾਲਾ ਚਿਕਨ ਬਹੁਤ ਮਸ਼ਹੂਰ ਹੈ ਤੁਸੀਂ ਉੱਥੇ ਪਹੁੰਚੋਂਗੇ ਉੱਥੇ ਨਾਲ ਜਲੰਧਰ 'ਚ ਹਵੇਲੀ ਆ ਉੱਥੇ ਸਾਰੇ ਟਰਡੀਸ਼ਨਲ ਫੂਡ ਮਿਲਦਾ ਤੁਸੀਂ ਉੱਥੇ ਜਾ ਕੇ ਜੋ ਮਰਜ਼ੀ ਆਪਣੇ ਪਸੰਦ ਦਾ ਟੇਸਟ ਲਉ ਹਾਂਜੀ ਹਾਂ ਉੱਥੇ ਵੀ ਹਾਂਜੀ ਹਾਂ ਮੈਂ ਤੁਹਾਡੇ ਨਾਲ ਚੱਲੂੰਗਾ ਜੀ ਉੱਥੇ ਜਾ ਕੇ ਤੁਹਾਡੇ ਵਧੀਆ ਵਧੀਆ ਫੂਡ ਟੇਸਟ ਕਰਾ ਕੇ ਤੁਹਾਨੂੰ ਵੀਡੀਓ ਜਿਹੜੀ ਤੁਸੀਂ ਬਣਾਉਣਾ ਚਾਹੁੰਦੇ ਹੋ ਆਰਾਮ ਨਾਲ ਬਣਾ ਸਕਦੇ ਹੋ ਰੇਟ ਤਾਂ ਬਹੁਤ ਜਾਇਜ਼ ਹੋਣਗੇ ਕੋਈ ਇੰਨੇ ਮਹਿੰਗੇ ਰੇਟ ਨਹੀਂ ਹੈਗੇ ਹਾਂਜੀ ਹਾਂ ਤੁਸੀਂ ਜਲਦੀ ਉਰੇ ਮਾਰੋ ਗੇੜਾ ਫਿਰ ਤੁਹਾਨੂੰ ਅਸੀਂ ਉਰੇ ਫਤਿਹਗੜ੍ਹ ਸਾਹਿਬ ਵੀ ਪਟਿਆਲੇ ਹਾਂਜੀ ਹਾਂ ਠੀਕ ਹੈ ਸਤਿ ਸ਼੍ਰੀ ਅਕਾਲ ਜੀ